ਹੈਲੋ ਮੈਂ ਮੈਂ ਕਿਸਾਨ ਹੈਗਾ ਮੈਂ ਝੋਨੇ ਦੇ ਬੀਜ ਲੈਣੇ ਆ ਗੇਹੂੰ ਦੇ ਬੀ ਬੀਜ ਲੈਣੇ ਆ ਅਤੇ ਹੋਰ ਵੀ ਤਰ੍ਹਾਂ ਦੇ ਬੀਜ ਲੈਣੇ ਆ ਆਰਗੈਨਿਕ ਬੀਜ ਵੀ ਨੇ ਤੁਹਾਡੇ ਕੋਲ ਠੀਕ ਹੈ ਅਤੇ ਉਹ ਬੀਜਾਂ ਵਿਚ ਦਵਾਈਆਂ ਵਗੈਰਾ ਤਾਂ ਨਹੀਂ ਮਿਕਸ ਕੀਤੀ ਤਾਂ ਨਹੀਂ ਹੈ ਹੂੰ ਹਾਂ ਵੈਸੇ ਕਿਸਾਨਾਂ ਲਈ ਤਾਂ ਫਸਲ ਹੀ ਵਧੀਆ ਹੁੰਦੀ ਆ ਜੇ ਫਸਲ ਨਹੀਂ ਤਾਂ ਕਿਸਾਨ ਕਿਸ ਕੰਮ ਦੇ ਸਾਰੀ ਸਬਜ਼ੀਆਂ ਦੇ ਵੀ ਬੀਜ ਮਿਲ ਜਾਣਗੇ ਚੰਗਾ ਔਰ ਕੀ ਕਿੰਨਾ ਰੇਟ ਹੋਵੇਗਾ ਉੰਨਾ ਬਾਜ਼ਾਰ ਜਿੰਨਾ ਹੀ ਹੋਵੇਗਾ ਜਾਂ ਘੱਟ ਮਿਲਣਗੇ ਮੈਨੂੰ ਇਹ ਫਸਲ ਚੰਗੀ ਹੋ ਜਾਵੇਗੀ ਅਤੇ ਫਸਲ ਚੰਗੀ ਹੋ ਜਾਵੇਗੀ ਉਹਦੇ ਨਾਲ ਬੀਜਾਂ ਨਾਲ ਠੀਕ ਹੈ ਔਰ ਔਰ ਔਰਗੈਨਿਕ ਬੀਜ ਹੋਣ ਤਾਂ ਮੈਂਨੂ ਵੀ ਦੱਸ ਦਿਓ ਜੇ ਤੁਸੀਂ ਮੈਂ ਹਾਂ